ਮੈਂ ਪਹਿਲਾਂ ਕਾਪੀ ਉੱਤੇ ਪੈੱਨ ਨਾਲ਼ ਲਿਖਦੀ ਸੀ ਪਰ ਹਰ ਵੇਲੇ ਕਾਪੀ ਆਪਣੇ ਨਾਲ਼ ਨਹੀਂ ਲਿਜਾ ਸਕਣ ਕਰਕੇ ਮੋਬਾਈਲ 'ਤੇ ਟਾਈਪ ਕਰ ਲੈਂਦੀ ਹਾਂ